ਅਠਾਰ੍ਹਾਂ ਜਨਵਰੀ ਦੋ ਹਜ਼ਾਰ ਇੱਕ ਪੰਦਰ੍ਹਾਂ ਨਵੰਬਰ ਦੋ ਹਜ਼ਾਰ ਤਿੰਨ ਅੱਠ ਅਗਸਤ ਦੋ ਹਜ਼ਾਰ ਉੱਨੀ ਨਵੰਬਰ ਦੋ ਹਜ਼ਾਰ ਤੇਈ ਪੰਜ ਜੂਨ ਦੋ ਹਜ਼ਾਰ ਤੇਈ